ਮੈਨੂੰ ਲੱਗਦਾ ਹੈ ਅੱਜ ਕੱਲ੍ਹ ਕੋਈ ਵੀ ਤਕਨੀਕ ਸਿੱਖਣਾ ਕੋਈ ਵੀ ਟਕਨੋਲਜੀ ਨੂੰ ਯੂਜ਼ ਕਰਨਾ ਸਿੱਖਣਾ ਬੜਾ ਆਸਾਨ ਹੈ ਕਿਉਂਕਿ ਯੂਟਿਊਬ ਇੱਕ ਐਵੇਂ ਦਾ ਪਲੈਟਫਾਰਮ ਆ ਜਿੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਗੈਜਟ ਨੂੰ ਚਲਾਉਣ ਲਈ ਕੋਈ ਨਾ ਕੋਈ ਵੀਡੀਓ ਜਰੂਰ ਮਿਲ ਜਾਂਦੀ ਆ ਇਸ ਤੋਂ ਇਲਾਵਾ ਜਦੋਂ ਵੀ ਕੋਈ ਕੰਪਨੀ ਕੋਈ ਇਲੈਕਟ੍ਰੋਨਿਕ ਡਿਵਾਈਸ ਕੋਈ ਕਾਰ ਹੈ ਕੁਛ ਵੀ ਕੋਈ ਵੀ ਚੀਜ਼ ਮਾਰਕੀਟ ਦੇ ਵਿੱਚ ਲੋਂਚ ਕਰਦੀ ਹੈ ਤਾਂ ਉਦੋਂ ਅਪਣੀ ਉਹ ਇੱਕ ਡੈਮੋ ਵੀਡੀਓ ਨਾਲ ਦਿੰਦੇ ਹੈ ਫੋਰ ਇਗਜਾਮਪਲ ਜਦੋਂ ਮੈਂ ਆਈਫੋਨ ਖਰੀਦਿਆ ਸੀ ਉਸ ਦੇ ਨਾਲ ਹੀ ਮੈਨੂੰ ਇੱਕ ਵੀਡੀਓ ਡੈਮੋ ਦਿੱਤਾ ਗਿਆ ਸੀਗਾ ਕਿ ਇਹਦੇ ਕਿਹੜੇ ਕਿਹੜੇ ਫੀਚਰ ਆ ਤੁਸੀਂ ਕਿਵੇਂ ਕਿਵੇਂ ਇਹਨਾਂ ਫੀਚਰਸ ਨੂੰ ਯੂਜ਼ ਕਰ ਸਕਦੇ ਹੋ ਅਤੇ ਉਹਨਾਂ ਫੀਚਰਸ ਦੇ ਨਾਲ ਮੈਨੂੰ ਕਿਵੇਂ ਹੈਲਪ ਹੋਏਗੀ ਮੈਂ ਆਪਣੀ ਸਟੱਡੀਜ਼ ਉਹਨੂੰ ਕਿਵੇਂ ਯੂਜ਼ ਕਰਦੀ ਹਾਂ ਕਿਵੇਂ ਕਰ ਸਕਦੀ ਆਂ ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਕੀ ਹੈ ਉਹਨਾਂ ਨੇ ਇੱਕ ਵੀਡੀਓ ਦੇ ਥਰੂ ਕੀ ਆ ਸ਼ੋ ਕੀਤਾ ਸੀਗਾ ਅਤੇ ਉੱਥੋਂ ਮੈਂ ਸਿੱਖਿਆ ਸੀਗਾ ਬਟ ਨਾਲ ਦੀ ਨਾਲ ਜਦੋਂ ਵੀ ਮੈਂ ਆਪਣੇ ਫੋਨ ਨੂੰ ਯੂਜ਼ ਕਰਦੀ ਹਾਂ ਇਹਦੇ 'ਚ ਹਰ ਵਾਰੀ ਕੋਈ ਨਾ ਕੋਈ ਨਵਾਂ ਫੀਚਰ ਆਇਆ ਹੁੰਦਾ ਹੈ ਸੋ ਮੈਂ ਹਮੇਸ਼ਾ ਕੀ ਹੈ ਸਭ ਤੋਂ ਪਹਿਲਾਂ ਯੂਟਿਊਬ 'ਤੇ ਜਾਂਦੀ ਹਾਂ ਉੱਥੇ ਸਰਚ ਕਰਦੀ ਹਾਂ ਕਿ ਇਹ ਵਾਲਾ ਅਗਰ ਕੋਈ ਐਪਲੀਕੇਸ਼ਨ ਹੈ ਤਾਂ ਉਹਨੂੰ ਕਿਵੇਂ ਯੂਜ਼ ਕਰਨਾ ਹੈ ਉਤੋਂ ਸਿੱਖਦੀ ਹਾਂ ਫਿਰ ਉਸ ਤੋਂ ਬਾਅਦ ਕੀ ਆ ਉਹਨੂੰ ਅਪਲਾਈ ਕਰਕੇ ਦੇਖਦੀ ਹਾਂ ਫਿਰ ਉਸ ਤੋਂ ਬਾਅਦ ਮੈਨੂੰ ਕੀ ਆ ਉਹ ਚੀਜ਼ ਬੜੀ ਆਸਾਨ ਹੋ ਜਾਂਦੀ ਮੇਰੇ ਲਈ ਸੋ ਮੈਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਟਕਨੋਲਜੀ ਨੂੰ ਸਿੱਖਣਾ ਕੋਈ ਬਹੁਤ ਜ਼ਿਆਦਾ ਮੁਸ਼ਕਿਲ ਨਹੀਂ ਹੈ ਕਿਉਂਕਿ ਤੁਹਾਨੂੰ ਯੂਟਿਊਬ 'ਤੇ ਗੂਗਲ 'ਤੇ ਹਰ ਇੱਕ ਪਲੈਟਫੋਰਮ 'ਤੇ ਤੁਹਾਨੂੰ ਉਸ ਡਿਵਾਈਸ ਨਾਲ ਰਿਲੇਟਿਡ ਵੀਡੀਓ ਮਿਲ ਜਾਂਦੇ ਜਿੱਥੋਂ ਤੁਸੀ ਵੀਡੀਓ ਦੇਖ ਕੇ ਉਹ ਚੀਜ਼ ਸਿੱਖ ਸਕਦੇ ਹੋ